ਮੈਂ ਪਹਿਲਾਂ ਆਪਣੇ ਸਕੂਲ ਦੀ ਫੁੱਟਬਾਲ ਟੀਮ ਵਿੱਚ ਸੀ ਮੈਂ ਆਪਣੇ ਸਕੂਲ ਦੀ ਫੁੱਟਬਾਲ ਟੀਮ ਦਾ ਕਪਤਾਨ ਸੀ ਸਾਡੇ ਸਕੂਲ ਅਤੇ ਦੋ ਹੋਰ ਸਕੂਲਾਂ ਵੱਲੋਂ ਖੇਡਾਂ ਦਾ ਕਾਰਿਆਕਮ ਕ੍ਰਮ ਕਰਵਾਇਆ ਗਿਆ ਉਸ ਵਿੱਚ ਮੈਂ ਅਤੇ ਮੇਰੀ ਟੀਮ ਨੇ ਵੀ ਹਿੱਸਾ ਲਿਆ ਅਸੀਂ ਉਸ ਸਪੋਰਟਸ ਮੀਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਸੀਂ ਫਾਈਨਲ ਤੱਕ ਪਹੁੰਚ ਗਏ ਸਾਡਾ ਫਾਈਨਲਸ ਵਿੱਚ ਮੁਕਾਬਲਾ ਡੀ ਪੀ ਐਸ ਸਕੂਲ ਦੇ ਵਿਦਿਆਰਥੀਆਂ ਦੀ ਫੁਟਬਾਲ ਟੀਮ ਨਾਲ ਸੀ ਅਸੀਂ ਉੱਥੇ ਵੀ ਬਹੁਤ ਮਿਹਨਤ ਨਾਲ ਖੇਡੇ ਅਸੀਂ ਪੂਰੀ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਅਸੀਂ ਤਿੰਨ ਗੋਲ ਮਾਰੇ ਅਤੇ ਡੀ ਪੀ ਐਸ ਸਕੂਲ ਦੇ ਵਿਦਿਆਰਥੀਆਂ ਨੇ ਚਾਰ ਗੋਲ ਮਾਰ ਕੇ ਮੈਚ ਜਿੱਤ ਲਿਆ ਪਰ ਉਸ ਸਪੋਰਟਸ ਮੀਟ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਭਾਵੇਂ ਅਸੀਂ ਹਾਰ ਗਏ ਸੀ ਪਰ ਸਾਨੂੰ ਕਈ ਚੀਜ਼ਾਂ ਸਿੱਖਣ ਨੂੰ ਮਿਲੀਆਂ ਖੇਡਣ ਦਾ ਇੱਕੋ ਇੱਕ ਮਕਸਦ ਜਿੱਤ ਤਾਂ ਨਹੀਂ ਹੁੰਦਾ ਸਾਨੂੰ ਉਸ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਸਪੋਰਟਸਮੈਨਸ਼ਿਪ ਕਿ ਹਾਰ ਕੇ ਵੀ ਸਾਨੂੰ ਦੂਜਿਆਂ ਨੂੰ ਉਹਨਾਂ ਦੀ ਜਿੱਤ ਲਈ ਆ ਵਧਾਈ ਦੇਣੀ ਚਾਹੀਦੀ ਹੈ ਮੈਨੂੰ ਉਸ ਦਾ ਅਨੁਭਵ ਹੁਣ ਤੱਕ ਯਾਦ ਹੈ